ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਤੁਸੀਂ ਸੰਧੂ ਕੈਬ ਆਟੋ ਬੁੱਕ ਤੋਂ ਬੋਲ ਰਹੇ ਹੋ ਅਸੀਂ ਦੋ ਘੰਟੇ ਪਹਿਲਾਂ ਵੀਰੇ ਤੁਹਾਡੇ ਕੋਲੋਂ ਕੈਬ ਕੀਤੀ ਸੀਗੀ ਜਿਹੜੀ ਕਿ ਹਲੇ ਤੱਕ ਨਹੀਂ ਪਹੁੰਚੀ ਹੈਗੀ ਦੋ ਘੰਟਿਆਂ ਤੋਂ ਉੱਪਰ ਹੋ ਚੁੱਕਿਆ ਹੈਗਾ ਟਾਈਮ ਅਤੇ ਇੱਥੇ ਮੇਰੇ ਕੋਲੋਂ ਖੜ੍ਹ ਵੀ ਨਹੀਂ ਹੁੰਦਾ ਹੈਗਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈਗੀ ਆ ਮੈਂ ਬਹੁਤ ਜ਼ਿਆਦਾ ਬਿਮਾਰ ਹੈਗੀ ਕਿਉਂਕਿ ਤੁਰ ਵੀ ਨਹੀਂ ਹੁੰਦਾ ਹੈਗਾ ਮੈਨੂੰ ਚੱਕਰ ਆ ਰਹੇ ਆ ਬਹੁਤ ਜ਼ਿਆਦਾ ਇੱਥੇ ਖੜ੍ਹਿਆਂ ਖੜ੍ਹਿਆਂ ਮੈਨੂੰ ਚੱਕਰ ਆ ਰਹੇ ਆ ਕਿਉਂਕਿ ਮੈਂ ਹੋਸਪਿਟਲ ਦੇ ਵਿੱਚੋਂ ਦਵਾਈ ਲੈਣ ਆਈ ਹੋਈ ਸੀਗੀ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਤੁਹਾਡੀ ਜਿਹੜੀ ਕੈਬ ਆ ਉਹ ਮੇਰੇ ਤੱਕ ਪਹੁੰਚੇਗੀ ਵੀ ਜਾਂ ਨਹੀਂ ਇੱਥੇ ਕੋਈ ਵੀ ਸਾਧਨ ਨਹੀਂ ਹੈਗਾ ਗਾ ਖੜ੍ਹਨ ਦੇ ਲਈ ਕਿ ਜਾਂ ਮੈਂ ਇੱਥੇ ਬੈਠ ਕੇ ਆਰਾਮ ਕਰ ਲਾ ਕੋਈ ਛਾਂ ਦਾ ਵੀ ਪ੍ਰਬੰਧ ਨਹੀਂ ਹੈਗਾ ਇੱਥੇ ਕੋਈ ਵੀ ਸ਼ਟਰ ਵਗੈਰਾ ਕੁਝ ਵੀ ਨਹੀਂ ਹੈਗਾ ਇੱਥੇ ਤਾਂ ਧੁੱਪ 'ਚ ਮੈਨੂੰ ਮੈਂ ਪਹਿਲਾਂ ਹੀ ਮੈਂ ਬਿਮਾਰ ਹੈਗੀ ਹਾਂ ਤਾਂ ਇੰਨੇ ਜ਼ਿਆਦਾ ਚੱਕਰ ਆ ਰਹੇ ਆ ਕਿ ਮੇਰੇ ਤੋਂ ਖੜ੍ਹ ਨਹੀਂ ਹੋ ਰਿਹਾ ਪਲੀਜ਼ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਕੈਬ ਮੇਰੇ ਤੱਕ ਪਹੁੰਚਾ ਸਕਦੇ ਹੋ ਜਾਂ ਫਿਰ ਵੀ ਮੈਂ ਘਰੋਂ ਕਿਸੇ ਨੂੰ ਕਾਲ ਕਰਕੇ ਬੁਲਾ ਲਵਾਂ ਪਲੀਜ਼ ਦੱਸ ਦਿਓ ਤੁਸੀਂ ਕਿੰਨੇ ਕੁ ਟਾਈਮ ਤੱਕ ਪਹੁੰਚਾ ਸਕਦੇ ਹੋ ਕੈਬ